ਸਿੱਖਿਆ ਨੇ ਬਹੁਤ ਸਾਰਾ ਅਸਰ ਪਾਇਆ ਹੈ ਸੱਭਿਆਚਾਰ 'ਤੇ ਜੇ ਗੱਲ ਕਰੀਏ ਤਾਂ ਪਹਿਲਾਂ ਲੋਕ ਜ਼ਿਆਦਾ ਕੰਮ ਹੱਥਾਂ ਨਾਲ ਕਰਦੇ ਸਨ ਹੁਣ ਅੱਜ ਦੇ ਸਮੇਂ ਵਿੱਚ ਮਸ਼ੀਨਰੀ ਯੁੱਗ ਹੋਣ ਕਰਕੇ ਲੋਕ ਫਸਲਾਂ ਦੀ ਬਜਾਈ ਵੀ ਮਸ਼ੀਨੀ ਢੰਗ ਨਾਲ ਸਾਰਾ ਕੰਮ ਮਸ਼ੀਨਾਂ ਨਾਲ ਹੁੰਦਾ ਹੈ ਜ਼ਿਆਦਾ ਸਪਰੇਹਾਂ ਜ਼ਿਆਦਾ ਪੈਦਾਵਾਰ ਕਰਕੇ ਲੋਕ ਖਾਦਾਂ ਸਪਰੇਹਾਂ ਦਾ ਜ਼ਿਆਦਾ ਇਸਤੇਮਾਲ ਕਰਦੇ ਨੇ ਉਹਦੇ ਨਾਲ ਸਰੀਰ ਵਿੱਚ ਕਈ ਤਰ੍ਹਾਂ ਜਿਸਦਾ ਖਾਣ ਨਾਲ ਬਹੁ ਜ ਬਹੁਤੀਆਂ ਸਪਰੇਆ ਨਾਲ ਪੈਦਾਵਾਰ ਤਾਂ ਵੱਧ ਜਾਂਦੀ ਹੈ ਪਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਜਮੀਨ ਬੰਜਰ ਹੋ ਜਾਂਦੀ ਹੈ ਕਈ ਤਰ੍ਹਾਂ ਦੀਆਂ ਬਿਮਾਰੀਆਂ ਸਰੀਰ ਨੂੰ ਲੱਗਦੀਆਂ ਨੇ ਜਿਸ ਤਰ੍ਹਾਂ ਕਿ ਸ਼ੂਗਰ ਅਤੇ ਬੀ ਪੀ ਪਹਿਲੇ ਸਮੇਂ ਵਿੱਚ ਲੋਕ ਆਪ ਹੱਥ ਨਾਲ ਕਿਰਤ ਕਰਨਾ ਪਸੰਦ ਕਰਦੇ ਸਨ ਜ਼ਿਆਦਾ ਹੱਥ ਨਾਲ ਕੋਈ ਮਸ਼ੀਨੀ ਚੀਜ਼ ਨਹੀਂ ਹੁੰਦੀ ਸੀ ਕਿਰਤ ਕਰਨ ਨਾਲ ਸਰੀਰ ਤੰਦਰੁਸਤ ਹੁੰਦਾ ਸੀ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਬਿਮਾਰੀ ਨਹੀਂ ਹੁੰਦੀ ਸੀ ਪਰ ਅੱਜ ਦੇ ਸਮੇਂ ਵਿੱਚ ਤਾਂ ਛੋਟੇ ਤੋਂ ਛੋਟੇ ਬੱਚੇ ਨੂੰ ਬੀ ਪੀ ਦੀ ਪ੍ਰੋਬਲਮ ਹੈ ਸ਼ੂਗਰ ਦੀ ਪ੍ਰੋਬਲਮ ਹੈ ਹੁਣ ਜ਼ਿਆਦਾ ਤਾਂ ਕਈ ਚ ਇਹੋ ਜਿਹੇ ਕਿੰਨੇ ਹੀ ਲੋਕ ਨੇ ਜਿਹਨਾਂ ਨੂੰ ਕੈਂਸਰ ਤੱਕ ਦੀ ਪ੍ਰੋਬਲਮ ਆ ਗਈ ਹੈ ਇਹ ਜ਼ਿਆਦਾ ਸਪਰੇਆਂ ਅਤੇ ਖਾਦਾਂ ਦੀਆਂ ਦਵਾਈਆਂ ਕਰਕੇ ਹੈ ਸਾਨੂੰ ਵੱਧ ਤੋਂ ਵੱਧ ਆਪਣੇ ਹੱਥੀ ਕਿਰਤ ਕਰਨੀ ਚਾਹੀਦੀ ਹੈ ਖਾਦਾਂ ਸਪਰੇਆਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ ਤਾਂ ਜੋ ਅਸ ਅਸੀਂ ਤੰਦਰੁਸਤ ਅਤੇ ਖੁਸ਼ਹਾਲ ਪੰਜਾਬ ਪਹਿਲਾਂ ਵਾਂਗੂ ਵਿਕਸਿਤ ਕਰ ਸਕੀਏ